ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਹਾਂਜੀ ਕੋਈ ਗੱਲ ਨਹੀਂ ਉਹਨਾਂ ਦੀ ਦਵਾਈ ਮਿਲ ਜੇਗੀ ਤੁਹਾਨੂੰ ਹਾਂਜੀ ਤੁਸੀਂ ਕੋਈ ਗੱਲ ਨਹੀਂ ਤੁਹਾਨੂੰ ਅਸੀਂ ਦਵਾਈ ਦੇਵਾਂਗੇ ਅਤੇ ਤੁਸੀਂ ਉਹਨਾਂ ਨੂੰ ਮਤਲਬ ਦੱਸਣਾ ਨਹੀਂ ਆ ਉਹਨਾਂ ਨੂੰ ਬਿਨਾਂ ਦੱਸੇ ਦਵਾਈ ਦੇ ਸਕਦੇ ਹੋ ਨਹੀਂ ਜੀ ਖਾਣ ਖੁਣ ਦਾ ਕੋਈ ਨਹੀਂ ਪਰਹੇਜ਼ ਤੁਸੀਂ ਮੈਡੀਸੀਨ ਦੇਣੀ ਆ ਤੁਸੀਂ ਸਾਡੇ ਕਲੀਨਿਕ 'ਤੇ ਆ ਜਾਣਾ ਅਤੇ ਸਿਰਫ ਪੰਜ ਸੌ ਰੁਪਏ ਦਾ ਖਰਚਾ ਹੋਣਾ ਹਾਂਜੀ ਜਦੋਂ ਮਰਜ਼ੀ ਆਓ ਜੀ ਸਾਡਾ ਕਲੀਨਿਕ ਖੁੱਲ੍ਹਾ ਹੀ ਹੁੰਦਾ ਸਵੇਰੇ ਨੌਂ ਵਜੇ ਤੋਂ ਪੰਜ ਵਜੇ ਤੱਕ ਜੀ ਹਾਂਜੀ ਹਾਂਜੀ ਸੰਡੇ ਸੰਡੇ ਛੁੱਟੀ ਹੁੰਦੀ ਆ ਜੀ ਹਾਂਜੀ ਹਾਂਜੀ ਜ਼ਰੂਰ ਜੀ ਠੀਕ ਓਕੇ ਹਾਂਜੀ ਕੋਈ ਨਹੀਂ ਉਹਨਾਂ ਨੂੰ ਦੇਖ ਕੇ ਫਿਰ ਹੀ ਦੱਸਾਂਗੇ ਤੁਸੀਂ ਲੈ ਆਇਓ ਉਹਨਾਂ ਨੂੰ ਨਾਲੇ ਸਾਡੇ ਕਲੀਨਿਕ 'ਚ ਹਾਂਜੀ ਠੀਕ ਹੈ ਜੀ ਓਕੇ ਜੀ